ਸਤਿ ਸ਼੍ਰੀ ਅਕਾਲ ਮੈਨੂੰ ਬਚਪਨ ਤੋਂ ਹੀ ਫੋਟੋਗ੍ਰਾਫੀ ਕਰਨ ਦਾ ਬਹੁਤ ਸ਼ੌਕ ਸੀ ਅਤੇ ਮੈਨੂੰ ਲੱਗਦਾ ਕਿ ਮੈਂ ਦੂਸਰੇ ਫੋਟੋਗ੍ਰਾਫਰ ਤੋਂ ਬਹੁਤ ਵੱਖਰੀ ਹਾਂ ਕਿਉਂਕਿ ਮੈਂ ਆਪਣੇ ਚਸ਼ਮੇ ਤੋਂ ਇੱਕ ਨਵੀਂ ਦੁਨੀਆ ਦੇਖਦੀ ਹਾਂ ਮੇਰਾ ਦੁਨੀਆ ਨੂੰ ਦੇਖਣ ਦਾ ਨਜ਼ਰੀਆ ਇੱਕ ਅਲੱਗ ਹੈ ਮੈਂ ਜਦੋਂ ਵੀ ਫੋਟੋ ਖਿੱਚਦੀ ਹਾਂ ਮੈਂ ਹਮੇਸ਼ਾ ਕੋਸ਼ਿਸ਼ ਕਰਦੀ ਹਾਂ ਕਿ ਮੈਂ ਇੱਦਾਂ ਫੋਟੋ ਖਿੱਚਾਂ ਕਿ ਉਹ ਆਪਣੀ ਇੱਕ ਕਹਾਣੀ ਇੱਕ ਵਿਸ਼ੇਸ਼ ਲਮਹਾ ਬਿਆਨ ਕਰ ਰਿਹਾ ਹੋ ਜਦੋਂ ਲੋਕ ਦੇਖੇ ਉਹਨਾਂ ਨੂੰ ਇੱਕ ਆਪਣੇ ਆਪ ਹੀ ਉਹ ਅਹਿਸਾਸ ਪਤਾ ਚੱਲੇ ਕਿ ਉਹ ਲੋਕ ਉਸ ਫੋਟੋ ਵਿੱਚ ਕੀ ਕਰ ਰਿਹਾ ਬੰਦਾ ਮੈਂ ਆਪਣੀ ਕ੍ਰੀਏਟੀਵਿਟੀ 'ਤੇ ਰੰਗ ਬਿਰੰਗੀਆਂ ਨਾਲ ਨਵੀਂ ਸੋਚ ਨੂੰ ਬਿਆਨ ਕਰਨ ਵਿੱਚ ਬਹੁਤ ਮਾਹਿਰ ਹੈਗੀ ਹਾਂ ਮੈਨੂੰ ਨਾਲੇ ਲੋਕਾਂ ਦੀ ਨਵੀਂ ਸੰਸਕ੍ਰਿਤੀ ਅਲੱਗ ਅਲੱਗ ਲੋਕਾਂ ਦੀ ਸੰਸਕ੍ਰਿਤੀ ਅਲੱਗ ਅਲੱਗ ਲੋਕ ਕਿਵੇਂ ਰਹਿੰਦੇ ਆ ਅਤੇ ਕਿੱਦਾਂ ਕੋਈ ਚੀਜ਼ਾਂ ਕਰਦੇ ਆ ਉਹਨਾਂ ਨੂੰ ਦੇਖਣ ਦਾ ਵੀ ਬਹੁਤ ਸ਼ੌਂਕ ਹੈ ਅਤੇ ਉਹਨਾਂ ਨੂੰ ਆਪਣੇ ਫੋਟੋਗ੍ਰਾਫ ਨਾਲ ਕਰਕੇ ਕੈਪਚਰ ਕਰਨ ਦਾ ਵੀ ਬਹੁਤ ਸ਼ੋਕ ਹੈ ਨਾਲੇ ਮੈਂ ਬਹੁਤ ਜਦੋਂ ਫੋਟੋ ਖਿੱਚਦੀ ਹਾਂ ਬਹੁਤ ਹਰ ਹਰ ਇੱਕ ਛੋਟੀ ਛੋਟੀ ਚੀਜ਼ 'ਤੇ ਧਿਆਨ ਦਿੰਦੀ ਹਾਂ ਜਿਵੇਂ ਕਿ ਰੰਗ 'ਤੇ ਲਾਈਟਨਿੰਗ 'ਤੇ ਕੰਪੋਜੀਸ਼ਨ 'ਤੇ ਫਰੇਮਿੰਗ 'ਤੇ ਅਤੇ ਮੇਰੇ ਖਿਆਲ ਨਾਲ ਮੈਂ ਇੱਕ ਅੱਛੀ ਫੋਟੋਗ੍ਰਾਫਰ ਹੈ ਪਰ ਅੱਗੇ ਵੀ ਮੈਂ ਕੋਸ਼ਿਸ਼ ਕਰਦੀ ਰਹਾਂ ਕਿ ਮੈਂ ਕਿ ਹੋਰ ਵਧੀਆ ਇੱਕ ਫੋਟੋਗ੍ਰਾਫਰ ਬਣ ਸਕਾਂ